ਸਾਡੇ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਸਰਸੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਹੀ ਬਣਦੀ ਹੈ ਅਤੇ ਮੈਂ ਉਹਨੂੰ ਬਣਾਉਣ 'ਚ ਬਹੁਤ ਹੀ ਟੈਲੈਂਟਡ ਹਾਂ ਜੋ ਕਿ ਮੇਰੀ ਦਾਦੀ ਦੁਆਰਾ ਮੈਨੂੰ ਸਿਖਾਈ ਗਈ ਸੀਗੀ ਅਤੇ ਮੇਰੇ ਘਰ ਦੇ ਉਹਨੂੰ ਖਾ ਕੇ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਹਨ ਅਤੇ ਉਹ ਮੈਂ ਸ ਪਕਵਾਨ ਮੈਂ ਸਰਸੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਆਪਣੇ ਘਰਦਿਆਂ ਲਈ ਬਹੁਤ ਹੀ ਪਿਆਰ ਜਿਹੇ ਤਰੀਕੇ ਨਾਲ਼ ਬਣਾਉਦੀ ਹਾਂ ਉਹ ਵੀ ਸਰਦੀਆਂ ਵਿੱਚ ਅਤੇ ਸਾਰੇ ਬਹੁਤ ਹੀ ਮਜ਼ੇ ਨਾਲ਼ ਖਾਂਦੇ ਹਨ